ਹਾਂਜੀ ਮੈਂ ਗੂਗਲ ਪੇ ਦੀ ਵਰਤੋਂ ਕੀਤੀ ਹੈ ਅਤੇ ਹੁਣ ਵੀ ਅਕਸਰ ਰੋਜ਼ ਅਤੇ ਕਾਰ ਵਿਹਾਰ ਵਾਲੇ ਜੀਵਨ ਦੇ ਵਿੱਚ ਕਰਦੀ ਹਾਂ ਇਹ ਮੇਰੇ ਲਈ ਬੜਾ ਸੁਵਿਧਾਜਨਕ ਇਸ ਤਰ੍ਹਾਂ ਹੈ ਕਿ ਇੱਕ ਤਾਂ ਰੋਜ਼ ਕਿਤੇ ਨਾ ਕਿਤੇ ਰੁੱਕ ਕੇ ਕਿਸੇ ਨਾ ਕਿਸ ਚੀਜ਼ ਲੈਣੀ ਪੈ ਜਾਂਦੀ ਹੈ ਜਾਂ ਆਉਣਾ ਜਾਣਾ ਪੈ ਜਾਂਦਾ ਹੈ ਅਤੇ ਕਈ ਵਾਰੀ ਆਟੋ ਵਾਲੇ ਨੂੰ ਦੇਣ ਲਈ ਖੁੱਲ੍ਹੇ ਪੈਸੇ ਨਹੀਂ ਹੁੰਦੇ ਜਾਂ ਸਬਜ਼ੀ ਵਾਲੇ ਤੋਂ ਸਬਜ਼ੀ ਭਾਜੀ ਲੈਣ ਵੇਲੇ ਖੁੱਲ੍ਹੇ ਪਾਸੇ ਪੈਸੇ ਨਹੀਂ ਹੁੰਦੇ ਤਾਂ ਕਰਕੇ ਜਾਂ ਅਗਰ ਪਰਸ ਪੁਰਸ ਵੀ ਘਰ ਭੁੱਲ ਜਾਈਏ ਤਾਂ ਸਿੱਧੇ ਬੈਂਕ ਤੋਂ ਔਨਲਾਈਨ ਹੀ ਗੂਗਲ ਪੇ ਨਾਲ ਪੈਸੇ ਦਿੱਤੇ ਲਿੱਤੇ ਜਾ ਸਕਦੇ ਹੈ ਜਿਹਦੇ ਕਰਕੇ ਬੜਾ ਸੌਖਾ ਹੋ ਗਿਆ ਬਾਕੀ ਜੇ ਕੋਈ ਦੂਰ ਵੀ ਦੂਰ ਬੈਠੇ ਨਾਲ ਵੀ ਟਰਾਂਜੈਕਸ਼ਨ ਕਰਨੀ ਹੈ ਜਾਂ ਬਾਹਰਲੇ ਦੇਸ਼ ਅੰਦਰ ਵੀ ਕੋਈ ਬੈਂਕ ਦੇ ਅੰਦਰ ਟਰਾਂਜੈਕਸ਼ਨ ਕਰਨੀ ਹੈ ਨੈੱਟ ਬੈਂਕਿੰਗ ਕਰਨੀ ਹੈ ਤਾਂ ਵੀ ਔਨਲਾਈਨ ਮਨੀ ਟਰਾਂਸਫਰ ਨਾਲ ਜਿਹੜਾ ਹੈ ਬਹੁਤ ਹੀ ਕੰਮ ਹਨ ਚਾਹੇ ਉਹ ਬਿਜ਼ਨਸ ਦੇ ਹੋਣ ਚਾਹੇ ਉਹ ਜੀਵਨ ਦੇ ਛੋਟੇ ਮੋਟੇ ਕਾਰਜ ਹੋਣ ਉਹ ਸੌਖੇ ਹੋ ਗਏ ਹਨ ਅਤੇ ਇਹਦੇ ਲਈ ਅਸੁਵਿਧਾਜਨਕ ਜਿਹੜੀ ਚੀਜ਼ ਇੱਕ ਮੇਰੇ ਲਈ ਬਣੀ ਉਹ ਇਹ ਸੀ ਕਿ ਮੈਂ ਹੱਥੀਂ ਜਿਹੜਾ ਕੈਸ਼ ਹੈ ਉਹ ਰੱਖਣਾ ਘਟਾ ਦਿੱਤਾ ਅਤੇ ਸਿੱਧੇ ਬੈਂਕ ਤੋਂ ਪੈਸੇ ਖਰਚਣ ਕਾਰਨ ਮੇਰੇ ਧਿਆਨ 'ਚ ਘੱਟ ਰਹਿੰਦਾ ਸੀ ਕਿ ਮੈਂ ਕਿੰਨੇ ਪੈਸੇ ਖਰਚ 'ਤੇ ਤਾਂ ਜਿਹੜਾ ਮੇਰੇ ਬਜਟ ਦਾ ਤਾਲਮੇਲ ਹੈ ਅਤੇ ਬੈਲੇਂਸ ਹੈ ਉਹ ਥੋੜ੍ਹਾ ਵਿਗੜ ਗਿਆ ਪਰ ਧਿਆਨ ਰੱਖਣ ਨਾਲ ਅਤੇ ਜੇ ਜੇ ਗੌਰ ਕੀਤੀ ਜਾਵੇ ਅਤੇ ਇਹਨੂੰ ਸੁਚੱਜੇ ਤਰੀਕੇ ਨਾਲ ਵਰਤਿਆ ਜਾਵੇ ਤਾਂ ਇਹ ਬੜਾ ਹੀ ਲਾਭਦਾਇਕ ਜਿਹੜਾ ਹੈ ਸਿੱਧ ਹੁੰਦਾ ਹੈ